ਜੇ ਕਿਸੇ ਵਿਸ਼ੇ 'ਤੇ ਲਿਖਣਾ ਹੋਵੇ ਅਤੇ ਮੈਂ ਲਿਖਣਾ ਚਾਹੁੰਦੀ ਹਾਂ ਤਾਂ ਉਹ ਵਿਸ਼ਾ ਦੇਸ਼ ਅਤੇ ਅਮਨ ਏਕਤਾ 'ਤੇ ਹੋਵੇਗਾ ਕਿਉਂਕਿ ਅੱਜ ਦੇ ਸਮੇਂ ਵਿੱਚ ਜੋ ਪੰਜਾਬ ਵਿੱਚ ਅਸੀਂ ਦੇਖ ਰਹੇ ਹਾਂ ਕਿ ਇਸ ਵਕਤ ਬਹੁਤ ਸੰਵੇਦਨਸ਼ੀਲ ਵਿਸ਼ਾ ਹੈ ਉਹ ਹੈ ਖਾਲਿਸਤਾਨ ਦਾ ਇੱਕ ਹੈ ਨਸ਼ਿਆਂ ਦਾ ਇਹ ਜੜ੍ਹ ਕਿੱਥੋਂ ਆ ਨਸ਼ਿਆਂ ਦੀ ਇਹ ਸਾਰੇ ਕੁਝ ਅਜਿਹੇ ਵਿਸ਼ੇ ਨੇ ਮੈਨੂੰ ਲੱਗਦਾ ਕੋਈ ਵੀ ਇਹਨਾਂ 'ਤੇ ਲਿਖਣ ਤੋਂ ਪਹਿਲਾਂ ਦਸ ਵਾਰ ਸੋਚੇਗਾ ਜਾਂ ਤਾਂ ਕੋਈ ਇਸ ਮਸਲੇ ਦਾ ਹੱਲ ਕਰਨਾ ਹੀ ਨਹੀਂ ਚਾਹੁੰਦਾ ਜਾਂ ਇਹ ਇੰਨੇ ਜ਼ਿਆਦਾ ਆਪਣੇ ਸਮਾਜ ਵਿੱਚ ਫੈਲ ਚੁੱਕੇ ਨੇ ਕਿ ਇਹਨਾਂ ਨੂੰ ਸਮਾਜ ਦੇ ਵਿੱਚੋਂ ਕੱਢਣਾ ਇਹਨਾਂ ਬਾਰੇ ਬੋਲਣਾ ਵੀ ਵਰਜਿਤ ਹੋ ਚੁੱਕਿਆ ਚਲੋ ਨਸ਼ੇ ਦਾ ਸ਼ਰਾਪ ਜੋ ਹੈ ਉਹ ਤਾਂ ਹੈ ਹੀ ਜੋ ਇਹ ਖਾਲਿਸਤਾਨ ਵਰਗੇ ਮਸਲੇ ਆ ਰਹੇ ਨੇ ਉਹ ਬਹੁਤ ਹੀ ਜ਼ਿਆਦਾ ਚਿੰਤਾਜਨਕ ਨੇ ਪੰਜਾਬ ਵਾਸਤੇ ਵੀ ਦੇਸ਼ ਵਾਸਤੇ ਵੀ ਇੱਕ ਨਾਗਰਿਕ ਹੋਣ ਦੇ ਨਾਤੇ ਸਭ ਤੋਂ ਪਹਿਲਾਂ ਅਸੀਂ ਭਾਰਤ ਦੇ ਨਾਗਰਿਕ ਹਾਂ ਫਿਰ ਪੰਜਾਬ ਦੇ ਅਤੇ ਦੇਸ਼ ਨੂੰ ਧਰਮ ਦੇ ਨਾਂ 'ਤੇ ਵੰਡਣਾ ਗਲਤ ਹੈ ਕੁਛ ਕੁ ਲੋਕਾਂ ਨੇ ਆਪਣੀ ਸੋਚ ਨੂੰ ਪੂਰੇ ਦੇਸ਼ ਦੀ ਜਾਂ ਪੂਰੇ ਕੌਮ ਦੀ ਸੋਚ ਬਣਾ ਦਿੱਤਾ ਮੈਨੂੰ ਨਹੀਂ ਲੱਗਦਾ ਕੋਈ ਅੱਜ ਦੇ ਸਮੇਂ ਵਿੱਚ ਦੰਗੇ ਚਾਹੁੰਦਾ ਜਾਂ ਕੋਈ ਯੁੱਧ ਚਾਹੁੰਦਾ ਕਿਉਂਕਿ ਇਹ ਦੰਗੇ ਯੁੱਧ ਦੇਸ਼ ਨੂੰ ਕਿੰਨੇ ਸਾਲ ਪਿੱਛੇ ਲੈ ਜਾਂਦੇ ਨੇ ਕਿੰਨੀਆਂ ਜਾਨਾਂ ਮਾਲਾਂ ਦਾ ਨੁਕਸਾਨ ਹੋ ਜਾਂਦਾ ਹੈ ਇਹ ਜਿਹਨਾਂ ਨਾਲ ਬੀਤਦੀ ਹੈ ਇਹ ਉਹੀ ਸਮਝ ਸਕਦਾ ਚੁਰਾਸੀ ਦੇ ਦੰਗਿਆਂ ਨੂੰ ਕੌਣ ਭੁੱਲ ਸਕਦਾ ਸਾਰਿਆਂ ਨੂੰ ਇਹੀ ਸੰਦੇਸ਼ ਜਾਣਾ ਚਾਹੀਦਾ ਕਿ ਅਮਨ ਨਾਲ ਰਹੋ ਸਾਰੇ ਪਿਆਰ ਨਾਲ ਰਹੋ ਇਹ ਸਾ ਆਪਣੇ ਸਾਰਿਆਂ ਦਾ ਦੇਸ਼ ਹੈ ਇਹ ਧੰਨਵਾਦ